ਸੋ ਮੇਰਾ ਸ਼ਹਿਰ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਇਸ ਇਹ ਨਾਲ ਨਾਲ ਜੁੜ ਬੋਲਿਆ ਜਾਂਦਾ ਹੈ ਹੜੱਪਾ ਸ ਹੜੱਪਾ ਸਿਵੇਲਾਈਜੇਸ਼ਨ ਸੋ ਇੱਥੇ ਮਿਉਜੀਅਮ ਹੈ ਜਿਹਦਾ ਨਾਮ ਹੈ ਆਰਕੋਲੋਜੀਕਲ ਮਿਉਜੀਅਮ ਹੈ ਬੜਾ ਫੇਮਸ ਹੈ ਸੋ ਇੱਥੇ ਹੀ ਸਾਨੂੰ ਕਈ ਪੁਰਾਤਨ ਚੀਜ਼ਾਂ ਮਿਲੀਆਂ ਹੈ ਜੋ ਕਿ ਜੋ ਕਿ ਲੋਕ ਇੱਥੇ ਦੇ ਯੂਜ਼ ਕਰਦੇ ਸੀ ਅਤੇ ਸਾਨੂੰ ਖੁਦਾਈ ਦੇ ਦੁਆ ਦੁਆਰਾ ਮਿਲੀਆਂ ਗਈਆਂ ਇੱਥੇ ਚੀਜ਼ਾਂ ਜੋ ਪ੍ਰੀਜਰਵ ਕੀਤੀਆਂ ਗਈਆਂ ਮਿਉਜੀਅਮ 'ਚ ਸੋ ਕਾਫ਼ੀ ਲੋਕ ਆਉਂਦੇ ਹੈ ਸੋ ਇਹ ਚੀਜ਼ਾਂ ਹਨ ਬਰਤਨ ਹੈ ਅਤੇ ਸਿੱਕੇ ਹੈ ਕੋਆਈਨ ਜਦੋ ਉਹ ਯੂਜ਼ ਕਰਦੇ ਸੀ ਅਤੇ ਉਹਨਾਂ ਦੇ ਟੂਲਜ਼ ਹੈ ਜਿਹੜੇ ਉਹ ਅ ਯੂਜ਼ ਕਰਦੇ ਸੀ ਸ਼ਿਕਾਰ ਲਈ ਯੂਜ਼ ਕਰਦੇ ਸੀ ਉਹ ਸਾਰੇ ਬੜੇ ਸੰਭਾਲ ਕੇ ਅ ਰੱਖੇ ਹੋਏ ਨੇ ਮਿਉਜੀਅਮ ਅਤੇ ਸਕੇਲਟਨ ਵੀ ਹੈ ਜਿਹੜੇ ਜੋ ਸਾਨੂੰ ਮਿਲਿਆ ਸੀ ਇਥੋਂ ਖੁਦਾਈ ਤੋਂ ਸੋ ਇਹ ਕਾਫ਼ੀ ਪਾਪੂਲਰ ਮਿਉਜੀਅਮ ਹੈ ਇੱਥੇ ਕਾਫ਼ੀ ਟੂਰਿਸਟ ਆਉਂਦੇ ਹੈ ਹਰੇਕ ਸਾਲ ਇੱਥੇ ਆਰਕਲੋਜਿਕਲ ਮਿਉਜੀਅਮ ਸੇ ਇਹ ਓਪਨ ਹੋਇਆ ਸੀ ਪਬਲਿਕ ਲਈ ਨਾਈਨਟੀ ਨਾਈਨਟੀ ਸੀਕਸ ਵਿੱਚ ਓਪਨ ਹੋਇਆ ਸੀ ਇਹ ਹੁਣ ਵੀ ਚੱਲ ਰਿਹਾ ਹੈ ਸੋ ਲੌਕਲ ਪੀਪਲ ਜਾਂਦੇ ਹੈ ਅਤੇ ਪੇਰੈਂਟਸ ਈਵਨ ਆਪਣੇ ਬੱਚਿਆਂ ਨੂੰ ਲਿਜਾਉਂਦੇ ਹੈ ਅਤੇ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਸਾਡਾ ਕਲਚਰ ਕੀ ਹੈ ਸਾਡਾ ਇਤਿਹਾਸ ਕੀ ਹੈ